ਮੈਨੂੰ ਕ੍ਰਿਕੇਟ ਖੇਡ ਪਸੰਦ ਅਤੇ ਮੈਂ ਸ਼ੁਰੂ ਤੋਂ ਹੀ ਕ੍ਰਿਕਟ ਖੇਡੀ ਹੈ ਮੈਨੂੰ ਕ੍ਰਿਕਟ ਖੇਡਣਾ ਬਹੁਤ ਵਧੀਆ ਲੱਗਦਾ ਹੈ ਕ੍ਰਿਕਟ ਮੈਂ ਨਾ ਦਿਲ ਨੂੰ ਸ ਐਨ ਤਸੱਲੀ ਕਰ ਦਿੰਦਾ ਸਕੂਨ ਮਿਲਦਾ ਮੈਨੂੰ ਖੇਲ ਕੇ ਆਰਾਮ ਮਿਲਦਾ ਮੈਂ ਮੇਰੀ ਸਿਹਤ ਇਹਦੇ ਨਾਲ ਠੀਕ ਰਹਿੰਦੀ ਹੈ ਤੰਦਰੁਸਤ ਰਹਿੰਦਾ ਮੈਂ ਇਹਦੇ ਨਾਲ ਇਹ ਮੇਰੇ ਦਿਲ ਨਾਲ ਲੱਗਿਆ ਹੋਇਆ ਕ੍ਰਿਕੇਟ ਕ੍ਰਿਕੇਟ ਕ੍ਰਿਕੇਟ ਮੈਂ ਸ਼ੁਰੂ ਤੋਂ ਹੀ ਖੇਡ ਰਿਹਾ ਏ ਕ੍ਰਿਕੇਟ ਮੈਨੂੰ ਖੇਡਣਾ ਵੀ ਬਹੁਤ ਵਧੀਆ ਲੱਗਦਾ ਏ ਦੇਖਣਾ ਵੀ ਬਹੁਤ ਵਧੀਆ ਲੱਗਦਾ ਏ ਇਹ ਮੇਰੇ ਦਿਲ ਨਾਲ ਜੁੜੀ ਹੈ ਇਹ ਕ੍ਰਿਕੇਟ ਹਮੇਸ਼ਾਂ ਹੀ ਮਤਲਬ ਜਦ ਤੱਕ ਮੈਂ ਠੀਕ ਹੈ ਜਦ ਤੱਕ ਖੇਡੂੰਗਾ ਕ੍ਰਿਕੇਟ ਕ੍ਰਿਕੇਟ ਨਹੀਂ ਛੱਡ ਹੁੰਦਾ ਮੈਨੂੰ ਖਾਸ ਤੌਰ 'ਤੇ ਕ੍ਰਿਕੇਟ ਬਹੁਤ ਵਧੀਆ ਲੱਗਦਾ ਦੇਖਣਾ ਜਦ ਫਿਲਿਪ ਹਿਊਜ ਦੀ ਡੈਥ ਹੋਈ ਤੀ ਉਸ ਟਾਈਮ ਮੈਂ ਬਹੁਤ ਸ ਡਰ ਜਿਹਾ ਲੱਗਦਾ ਤਾ ਖੇਡਣ ਵਿੱਚ ਮੈਂ ਬਹੁਤ ਜਗ੍ਹਾ ਖੇਡ ਚੁੱਕਿਆਂ ਕ੍ਰਿਕੇਟ ਜਲੰਧਰ ਤੋਂ ਵੀ ਅੱਗੇ ਫਾਜਿਲਕਾ ਸਟੇਟ ਮੈਂ ਸਟੇਟ ਖੇਲ ਚੁੱਕਿਆ ਹਾਂ ਡਿਸਟ੍ਰਿਕਟ ਵੀ ਖੇਲ ਲਿਆ ਸਟੇਟ ਵੀ ਖੇਲ ਚੁੱਕਿਆ ਏ ਨੈਸ਼ਨਲ ਦੇ ਕੈਂਪ ਲਾਏ ਹੋਏ ਨੇ ਮੈਂ ਇਹ ਮੈਂ ਬਹੁਤ ਦੂਰ ਦੂਰ ਖੇਡ ਚੁੱਕਿਆ ਹੈ ਨਾ ਕ੍ਰਿਕੇਟ ਮੇਰੇ ਨਾਲ ਇੱਕ ਕਹਿੰਦੇ ਆ ਇੱਕ ਸੁਪਨਾ ਹੈ ਵੀ ਵਧੀਆ ਖੇਡਣਾ ਏ ਇੱਕ ਥਾਂ 'ਤੇ ਪਹੁੰਚਣਾ ਇਹ ਮੇਰਾ ਸੁਪਨਾ ਹੈ ਕ੍ਰਿਕਟ ਇੱਕ ਬਹੁਤ ਵਧੀਆ ਚੀਜ਼ ਹੈ ਜਿਹੜਾ ਖੇਡਦੇ ਉਹਨਾਂ ਨੂੰ ਪਤਾ ਹੈ ਮੈਂ ਇਹ ਕ੍ਰਿਕਟ 'ਚ ਅੱਗੇ ਵਧਣਾ ਚਾਹੁੰਦਾ ਏ ਕ੍ਰਿਕੇਟ ਇਹ ਬਹੁਤ ਬਹੁਤ ਅੱਜ ਕੱਲ੍ਹ ਦੇ ਡੇ ਵਿੱਚ ਬਹੁਤ ਪਾਪੂਲਰ ਹੋ ਰਿਹਾ ਹੈ